ਅੱਜ ਦੇ ਸਮੇਂ ਵਿੱਚ ਹੁਨਰਮੰਦ ਕਿਰਤੀਆਂ ਨੂੰ ਲੱਭਣ ਅਤੇ ਉਹਨਾਂ ਨੂੰ ਰੱਖਣ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅੱਜ ਕੱਲ੍ਹ ਦੇ ਹੁਨਰਮੰਦ ਅਤੇ ਕਿਰਤੀ ਆਪਣੇ ਨਵਾਸਥਾਨ ਤੋਂ ਦੂਸਰੀ ਜਗ੍ਹਾ ਪਲੈਨ ਕਰ ਰਹੇ ਨੇ ਜਿਸ ਕਾਰਨ ਉਹਨਾਂ ਨੂੰ ਲੋਕਲ ਲੋਕਾਂ ਨੂੰ ਉਹਨਾਂ ਦਾ ਬਹੁਤ ਜ਼ਿਆਦਾ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜ਼ਿਆਦਾਤਰ ਦਿਹਾੜੀ ਮਜ਼ਦੂਰਾਂ ਕਿਰਤੀ ਹੁਨਰਮੰਦ ਆਪਣੇ ਹੋਰ ਜਗ੍ਹਾ 'ਤੇ ਪਲੈਨ ਕਰ ਰਹੇ ਨੇ ਅੱਜ ਕੱਲ੍ਹ ਦੇ ਮੌਜੂਦਾ ਸਮੇਂ ਵਿੱਚ ਮਜ਼ਦੂਰ ਦੀ ਤਨਖਾਹ ਚਾਰ ਸੌ ਰੁਪਿਆ ਅਤੇ ਹੁਨਰਮੰਦ ਕਿਰਤੀ

ਛੇ ਸੌ ਰੁਪਿਆ ਤਨਖਾਹ ਮਿਲਦੀ ਹੈ